ਸਿੱਖਿਆ ਨੇ ਅੱਜ ਕੱਲ੍ਹ ਦੀ ਜਨਰੇਸ਼ਨ ਅਤੇ ਸੱਭਿਆਚਾਰ ਉੱਤੇ ਬਹੁਤ ਅਸਰ ਪਾਏ ਹੋਏ ਆ ਅ ਪਹਿਲਾਂ ਪਹਿਲਾਂ ਵਾਲੇ ਲੋਕ ਜਿਵੇਂ ਚੁੱਲ੍ਹਿਆਂ ਅਤੇ ਤੰਦੂਰਾਂ 'ਤੇ ਕੰਮ ਕਰਦੇ ਸੀ ਹੱਥੀਂ ਕੰਮ ਕਰਦੇ ਸੀ ਸਾਰੇ ਅੱਜ ਕੱਲ੍ਹ ਦੇ ਲੋਕ ਗੈਸ 'ਤੇ ਗੈਸ ਅਤੇ ਇੰਡਕਸ਼ਨਾਂ ਬਿਜਲੀ ਵਾਲੇ ਇੰਡਕਸ਼ਨ 'ਤੇ ਕੰਮ ਕਰ ਰਹੇ ਆ ਕੋਈ ਤੰਦੂਰ 'ਤੇ ਨਹੀਂ ਹਮ ਛ ਅੱਗੇ ਲੋਕ ਛਟੀਆਂ ਨਾਲ ਕੰਮ ਕਰਦੇ ਸੀਗੇ ਅਤੇ ਅੱਜ ਕੱਲ੍ਹ ਬੱਚੇ ਅੱਜ ਕੱਲ ਦੇ ਬੱਚੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਛਟੀਆਂ ਤੰਦੂਰ ਬਾਰੇ ਕੁਝ ਪਤਾ ਵੀ ਨਹੀਂ ਹੈ ਅਤੇ ਅੱ ਪਹਿਲਾਂ ਵਾਲੇ ਲੋਕ ਸੱਭਿਆਚਾਰਕ ਭੰਗੜਾ ਗਿੱਧਾ ਵਗੈਰਾ ਕਰਦੇ ਸੀ ਹੁਣ ਅੱਜ ਕੱਲ੍ਹ ਦੇ ਬੱਚੇ ਡਾਂਸ ਵਗੈਰਾ ਐਡੀਸ਼ਨਲ ਡਾਂਸ ਵਗੈਰਾ ਕਰ ਰਹੇ ਹਨ ਅਤੇ ਪਹਿਲਾਂ ਪਹਿਲਾਂ ਲੋਕ ਅ ਵਿਆਹ ਵਿਆਹ ਸ਼ਾਦੀਆਂ ਵਿੱਚ ਅ ਵਿਆਹ ਤੋਂ ਹਫ਼ਤਾ ਹਫ਼ਤਾ ਪਹਿਲਾਂ ਜਿਵੇਂ ਕਿ ਗੀਤ ਗਾਉਂਦੇ ਸਨ ਅੱਜ ਕੱਲ੍ਹ ਦੇ ਲੋਕ ਵਿਆਹ ਵਿੱਚ ਕੋਈ ਗੀਤ ਨਹੀਂ ਗਾ ਰਹੇ ਅ ਡੀਜਿਆਂ 'ਤੇ ਡੀਜਿਆਂ 'ਤੇ ਗਾਣਿਆਂ 'ਤੇ ਡਾਂਸ ਵਗੈਰਾ ਕਰ ਰਹੇ ਹਨ ਇਹ ਸੱਭਿਆ ਇਹ ਸਿੱਖਿਆ ਨੇ ਸਿੱਖਿਆ ਦੇ ਨਾਲ ਨਾਲ ਲੋਕ ਮੌਡਰਨ ਹੁੰਦੇ ਜਾ ਰਹੇ ਹਨ ਅਤੇ ਪਹਿਲਾਂ ਵਾਲੇ ਲੋਕ ਅਨਪੜ ਸੀ ਪਰ ਸੱਭਿਆਚਾਰ ਦਾ ਖਿਆਲ ਰੱਖਦੇ ਸੀਗੇ ਅ ਪਹਿਲਾਂ ਵਾਲੀ ਔਰਤਾਂ ਔਰਤਾਂ ਘੱਗਰੇ ਅਤੇ ਪੁਰਸ਼ ਚਾਦਰੇ ਕੁੜਤੇ ਚਾਦਰੇ ਵਗੈਰਾ ਪਾ ਕੇ ਰੱਖਦੇ ਸਨ ਅੱਜ ਕੱਲ੍ਹ ਦੇ ਬੱਚੇ ਜੀ ਜੀਨਾਂ ਵਗੈਰਾ ਔਰ ਸ਼ੋਟ ਕੱਪੜਿਆਂ ਪਾ ਰਹੇ ਹਨ